ਡਾਇਰੀ ਉਤਪਾਦਨ ਇੱਕ ਕਿਸਮ ਦਾ ਭੋਜਨ ਹੁੰਦਾ ਹੈ ਜੋ ਕਿ ਸੰਤਧਾਰੀ ਜੀਵਾਂ ਤੋਂ ਆਮ ਤੌਰ 'ਤੇ ਡੰਗਰਾਂ ਮੱਝਾਂ ਬੱਕਰੀਆਂ ਤੋਂ ਪ੍ਰਾਪਤ ਹੁੰਦਾ ਹੈ ਡਾਇਰੀ ਉਤਪਾਦਨ ਵਿੱਚ ਖਾਣ ਵਾਲੀਆਂ ਚੀਜ਼ਾਂ ਜਿਵੇਂ ਦੁੱਧ ਦਹੀਂ ਪਨੀਰ ਅਤੇ ਮੱਖਣ ਸ਼ਾਮਿਲ ਹੁੰਦੇ ਹਨ ਡਾਇਰੀ ਉਤਪਾਦਨ ਜੋ ਕਿ ਈ ਇੱਕ ਫੋਰਮ ਹੁੰਦੀ ਹੈ ਜਿਸ ਵਿੱਚ ਪਸ਼ੂਆਂ ਨੂੰ ਨੂੰ ਰੱਖਿਆ ਜਾਂਦਾ ਹੈ ਅੱਜ ਕੱਲ੍ਹ ਦੀ ਟੈਕਨੋਲਜੀ ਨਾਲ ਪਸ਼ੂਆਂ ਨੂੰ ਉੱਥੇ ਇਹ ਵਧੀਆ ਢੰਗ ਨਾਲ ਰੱਖਿਆ ਜਾਂਦਾ ਹੈ ਜੀ ਜਿਸ ਕਰਕੇ ਪਸ਼ੂਆਂ ਦੀ ਸਾਫ ਸਫਾਈ ਅਤੇ ਆਲਾ ਦੁਆਲਾ ਸਾਫ ਰੱਖਿਆ ਜਾਂਦਾ ਹੈ ਅੱਜ ਕੱਲ੍ਹ ਨਵੀਂ ਟੈਕਨੋਲਜੀ ਦੀਆਂ ਦੁੱਧ ਕੱਢਣ ਵਾਲੀਆਂ ਮਸ਼ੀਨਾਂ ਦਾ ਵੀ ਉਪਯੋਗ ਕੀਤਾ ਜਾਂਦਾ ਹੈ ਪੂਰਬ ਅਤੇ ਦੱਖਣੀ ਪੂਰਵ ਏਸ਼ੀਆ ਦੇ ਬਹੁਤ ਸਾਰੇ ਇਲਾਕੇ ਅਤੇ ਮੱਧ ਅਫ਼ਰੀਕਾ ਦੇ ਬਹੁਤ ਸਾਰੇ ਹਿੱਸਿਆਂ ਤੋਂ ਇਲਾਵਾ ਦੁਨੀਆਂ ਭਰ ਵਿੱਚ ਡਾਇਰੀ ਉਤਪਾਦਨ ਦਾ ਸੇਵਨ ਕੀਤਾ ਜਾਂਦਾ ਹੈ ਡਾਇਰੀ ਉਤਪਾਦਨ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਦੁੱਧ ਦੁੱਧ ਨੂੰ ਜਿਵੇਂ ਕਿ ਅਲੱਗ ਅਲੱਗ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ਜਿਸ ਵਿੱਚ ਕਰੀਮ ਮੱਖਣ ਪਨੀਰ ਅਤੇ ਦਹੀਂ ਆਉਂਦਾ ਹੈ ਦਹੀਂ ਜੋ ਕਿ ਇੱਕ ਵਧੀਆ ਪੋਸ਼ਿਕ ਤੱਤ ਹੈ ਜੋ ਕਿ ਮੁੱਖ ਤੌਰ 'ਤੇ ਏ ਏ ਵਧੀਆ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਮੱਖਣ ਜ਼ਿਆਦਾਤਰ ਦੁੱਧ ਦੀ ਫੈਟ ਅਤੇ ਕਰੀਮ ਦੇ ਤੋਂ ਤਿਆਰ ਕੀਤਾ ਜਾਂਦਾ ਹੈ ਪਨੀਰ ਦੁੱਧ ਨੂੰ ਜਮ੍ਹਾ ਕਰਕੇ ਪਨੀਰ ਤੋਂ ਵੱਧ ਵੱਧ ਪੋਸ਼ਿਕ ਤੱਤ ਪ੍ਰਾਪਤ ਕੀਤੇ ਜਾਂਦੇ ਹਨ